ਹੈਲੋ ਐਮਾਜੋਨ ਕਸਟਮਰ ਕੇਅਰ ਤੋਂ ਬੋਲਦੇ ਹੋ ਜੀ ਬਲਜਿੰਦਰ ਬੋਲਦਾ ਸੀ ਬਾਈ ਜੀ ਹਾਂਜੀ ਮੈਂ ਨਾ ਵੀਹ ਕੁ ਦਿਨ ਪਹਿਲਾਂ ਹੈੱਡਫੋਨ ਮੰਗਵਾਏ ਸੀ ਬਹੁਤ ਵਧੀਆ ਹੈੱਡਫੋਨ ਸੀ ਹਾਂ ਮੈਨੂੰ ਬਹੁਤ ਜ਼ਰੂਰਤ ਸੀ ਉਹਨਾਂ ਦੀ ਬਾਜ਼ਾਰ ਵਿੱਚੋਂ ਉਹ ਮੈਨੂੰ ਮਿਲਦੇ ਦੋ ਸੌ ਰੁਪਏ ਦੇ ਅਤੇ ਤੁਹਾਡੇ ਤੋਂ ਮਿਲੇ ਸੱਤਰ ਰੁਪਏ 'ਚ ਪੈਕਿੰਗ ਵੀ ਬਹੁਤ ਵਧੀਆ ਸੀ ਉਹਨਾਂ ਦੀ ਅਤੇ ਮੈਨੂੰ ਸਮੇਂ ਸਿਰ ਮਿਲ ਗਏ ਮੈਨੂੰ ਬਹੁਤ ਜ਼ਰੂਰਤ ਸੀ ਉਹਨਾਂ ਦੀ ਲੋੜ ਸੀ ਉਹਨਾਂ ਦੀ ਆਵਾਜ਼ ਬਹੁਤ ਸਾਫ਼ ਆਉਂਦੀ ਹੈ ਮੈਂ ਉਹਨਾਂ ਤੋਂ ਪੂਰੇ ਚੰਗੀ ਤੁਹਾਡੇ ਤੋਂ ਚੰਗੀ ਤਰ੍ਹਾਂ ਐਮਾਜੋਨ ਤੋਂ ਸੰਤੁਸ਼ਟ ਹਾਂ ਡਿਲੀਵਰੀ ਵੀ ਬਹੁਤ ਫਾਸਟ ਹੋਈ ਮੈਨੂੰ ਲੋੜ ਸੀ ਜੇ ਮੈਂ ਸ਼ਹਿਰ ਆਉਂਦਾ ਐਕਸਟਰਾ ਮੇਰਾ ਹੋਰ ਖਰਚਾ ਹੁੰਦਾ ਅਤੇ ਸੱਤਰ ਰੁਪਏ ਵਿੱਚ ਹੀ ਮੈਨੂੰ ਘਰ ਪਹੁੰਚ ਗਏ ਮੈਂ ਅੱਗੇ ਤੋਂ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਊਗੀ ਤਾਂ ਸੋ ਤੁਹਾਡੇ ਤੋਂ ਹੀ ਬੁਕਿੰਗ ਕਰਕੇ ਮੰਗਵਾਊਂਗਾ ਹੈੱਡਫੋਨ ਬਹੁਤ ਵਧੀਆ ਸਾਫ਼ ਚੱਲਦੇ ਹੈ